ਪੰਜਾਬੀ ਭੰਗੜਾ ਪੰਜਾਬ ਦਾ ਫੇਮਸ ਅਤੇ ਪੰਜਾਬੀ ਕਲਚਰ ਦਾ ਸਭ ਤੋਂ ਵਧੀਆ ਭੰਗੜਾ ਹੈ ਪੰਜਾਬੀ ਭੰਗੜੇ ਵਿੱਚ ਅਸੀਂ ਸਾਰੇ ਪੰਜਾਬੀਅਤ ਦੀ ਝਲਕ ਦੇਖਦੇ ਹਾਂ ਪੰਜਾਬ ਵਿੱਚ ਪੰਜਾਬੀ ਭੰਗੜਾ ਪੰਜਾਬੀਅਤ ਨੂੰ ਦਰਸਾਉਂਦਾ ਹੈ ਪੰਜਾਬ ਵਿੱਚ ਭੰਗੜੇ ਦਾ ਹੋਣਾ ਇੱਕ ਲਾਜ਼ਮੀ ਚੀਜ਼ ਹੈ ਪੰਜਾਬੀ ਭੰਗੜੇ ਵਿੱਚ ਬਹੁਤ ਸਾਰੇ ਪੰਜਾਬੀ ਗੱਭਰੂ ਮੁਟਿਆਰਾਂ ਹਿੱਸਾ ਲੈਂਦੇ ਹਨ ਪੰਜਾਬੀ ਭੰਗੜੇ ਵਿੱਚ ਅਸੀਂ ਦੇਖਦੇ ਹਾਂ ਪੰਜਾਬੀਅਤ ਦੀ ਝਲਕ ਦਿਖਾਈ ਦਿੰਦੀ ਹੈ ਪੰਜਾਬ ਵਿੱਚ ਸਾਨੂੰ ਪੰਜਾਬੀਅਤ ਦੀ ਝਲਕ ਦਿਖੇਗੀ ਭੰਗੜੇ ਵਿੱਚ ਪੰਜਾਬੀਅਤ ਇਸ ਤਰ੍ਹਾਂ ਨਾਲ ਪੰਜਾਬੀ ਭੰਗੜਾ ਦਰਸਾਉਂਦੇ ਨੇ ਪੰਜਾਬ ਦੀ ਆਨ ਸ਼ਾਨ ਵਿੱਚ ਸਨਾਉਂਦੀ ਹੈ ਛੱਬੀ ਜਨਵਰੀ ਪੰਦਰ੍ਹਾਂ ਅਗਸਤ ਵਿੱਚ ਚਲ ਝਾਂਕੀਆਂ ਵਿੱਚ ਵੀ ਪੰਜਾਬੀ ਭੰਗੜਾ ਦਰਸਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਆ ਦਰਸਾਉਂਦਾ ਹੈ ਪੰਜਾਬੀ ਕਲਚਰ ਨੂੰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਪੰਜਾਬੀ ਭੰਗੜਾ ਪੰਜਾਬੀਅਤ ਦੀ ਨਿਸ਼ਾਨੀ ਬਣ ਚੁੱਕਿਆ ਹੈ ਪੰਜਾਬੀ ਭੰਗੜਾ ਪੰਜਾਬ ਤੋਂ ਬਾਹਰ ਵੀ ਫੇਮਸ ਹੈ ਬਾਹਰਲੀ ਸਟੇਟਾਂ ਬਾਹਰਲੇ ਦੇਸ਼ ਇਸਨੂੰ ਪਸੰਦ ਕਰਦੇ ਨੇ ਦੂਰੋਂ ਦੂਰੋਂ ਲੋਕ ਇਸਨੂੰ ਸਿੱਖਣ ਲਈ ਪੰਜਾਬ ਵਿੱਚ ਹਾਜਰੀ ਲਵਾਉਂਦੇ ਨੇ ਪੰਜਾਬੀ ਭੰਗੜਾ ਪੰਜਾਬੀ ਸਿੰਗਰਾਂ ਦੀ ਪਹਿਲੀ ਪਹਿਚਾਣ ਹੁੰਦੀ ਹੈ ਪੰਜਾਬੀ ਭੰਗੜਾ ਪਾਉਣ ਨਾਲ ਸਰੀਰ ਦੀ ਫਿਟਨੈਸ ਵੀ ਸਹੀ ਰਹਿੰਦੀ ਹੈ ਪੰਜਾਬੀ ਭੰਗੜਾ ਪੰਜਾਬ ਭਰ ਵਿੱਚ ਧੂੰਮ ਧਾਮ ਨਾਲ ਵਿਸਾਖੀ ਵਾਲੇ ਦਿਨ ਬਹੁਤ ਚਾਵਾਂ ਨਾਲ ਜੋ ਕਿ ਸਾਡਾ ਤਿਉਹਾਰ ਹੈ ਉਸ ਦਿਨ ਪੰਜਾਬੀ ਭੰਗੜਾ ਪਾ ਕੇ ਲੋਕੀ ਆਪਣਾ ਖੁਸ਼ੀ ਦਾ ਇਜਹਾਰ ਕਰਦੇ ਨੇ ਡੀਜੇ 'ਤੇ ਪੰਜਾਬੀ ਭੰਗੜਾ ਚਲਦਾ ਹੈ ਫਿਲਮੀ ਗਾਣਿਆਂ ਵਿੱਚ ਪੰਜਾਬੀ ਭੰਗੜਾ ਚਲਦਾ ਹੈ ਬੋਲੀਵੁੱਡ ਵਿੱਚ